ਕਸਰਤ ਜਾਂ ਗਤੀਵਿਧੀਆਂ ਦੇ ਹੋਰ ਰੂਪ ਨਾਲ ਯੋਗਾਂ ਨੂੰ ਅਸੀਂ ਸੰਤੁਲਿਤ ਕਰਦੇ ਹਾਂ ਜਿਵੇਂ ਕਿ ਸਾਨੂੰ ਦੇਖਣਾ ਚਾਹੀਦਾ ਹੈ ਕਿ ਨੇਚਰ ਕਿੱਦਾਂ ਹੈ ਕਿਵੇਂ ਅਸੀਂ ਆਪਣੀ ਸਿਹਤ ਨੂੰ ਮੈਨਟੇਨ ਰੱਖ ਸਕਦੇ ਹਾਂ ਸਾਡੇ ਉੱਠਣ ਅਤੇ ਸੌਣ ਦਾ ਟਾਈਮ ਕੀ ਖਾਣਾ ਪੀਣਾ ਚਾਹੀਦਾ ਹੈ ਯੋਗਾ ਸਾਡੀ ਸਿਹਤ ਨੂੰ ਤੰਦਰੁਸਤ ਰੱਖਣਾ ਰਹਿਣ ਵਿੱਚ ਬਹੁਤ ਹੀ ਜ਼ਿਆਦਾ ਲੋੜਵੰਦ ਹੈ ਯੋਗਾ ਜਿਹੜਾ ਬੰਦਾ ਯੋਗਾ ਕਰਦਾ ਹੈ ਉਹ ਤੰਦਰੁਸਤ ਰਹਿੰਦਾ ਹੈ ਨਾ ਉਸਨੂੰ ਕੋਈ ਬਿਮਾਰੀ ਲੱਗਦੀ ਹੈ ਨਾ ਉਹਦੀਆਂ ਬੋਨਸ ਵਗੈਰਾ ਕਮਜ਼ੋਰ ਹੁੰਦੀਆਂ ਹਨ ਜੇ ਕੋਈ ਬਿਮਾਰ ਬੰਦਾ ਡਾਕਟਰ ਕੋਲ ਜਾਂਦਾ ਹੈ ਤਾਂ ਡਾਕਟਰ ਵੀ ਅਕਸਰ ਜਾਂ ਤਾਂ ਯੋਗਾ ਦੱਸਦੇ ਹਨ ਅਤੇ ਜਾਂ ਕਹਿੰਦੇ ਹਨ ਕਿ ਸਵੇਰੇ ਸਵੇਰੇ ਤੁਹਾਨੂੰ ਹਰੇ ਘਾਹ ਉੱਤੇ ਸੈਰ ਕਰਨੀ ਚਾਹੀਦੀ ਹੈ ਜੋ ਕਿ ਸਾਡਾ ਬਲੱਡ ਸਰਕੂਲੇਸ਼ਨ ਸਹੀ ਰੱਖਦੀ ਹੈ ਜਿਵੇਂ ਕਿ ਰਾਮਦੇਵ ਜੀ ਵੀ ਸਾਨੂੰ ਇਹੀ ਦੱਸਦੇ ਹਨ ਕਿ ਚਾਹੇ ਥੋੜ੍ਹਾ ਟਾਈਮ ਪਰ ਯੋਗਾ ਕਰਨਾ ਚਾਹੀਦਾ ਹੈ ਯੋਗਾ ਸਾਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ ਇਸ ਨਾਲ ਸਾਡੀ ਸਿਹਤ ਦੇ ਨਾਲ ਨਾਲ ਸਾਡਾ ਦਿਮਾਗ ਵੀ ਸਾਰਾ ਦਿਨ ਫਰੈਸ਼ ਰਹਿੰਦਾ ਹੈ